ਖੇਡਾਂ ਸਾਡੇ ਜੀਵਨ 'ਤੇ ਬਹੁਤ ਹੀ ਅੱਛੇ ਪ੍ਰਭਾਵ ਪਾ ਸਕਦੀਆਂ ਹਨ ਇਹ ਪ੍ਰਭਾਵ ਆਉਣ ਵਾਲੀ ਪੀੜ੍ਹੀ 'ਤੇ ਬਹੁਤ ਹੀ ਵਧੀਆ ਅਤੇ ਟਿਕਾਊ ਰਹਿਣਗੇ ਅਗਰ ਕੋਈ ਬੱਚਾ ਮੁੱਢਲੇ ਜੀਵਨ ਤੋਂ ਕੋਈ ਖੇਡ ਅਪਣਾਉਂਦਾ ਹੈ ਤਾਂ ਉਹ ਉਹਦੀ ਹੈਲਥ ਫਿਟਨੈਸ ਵੀ ਵਧੀਆ ਰਹੇਗੀ ਮੈਂ ਚਾਹੁੰਦਾ ਹੈ ਕਿ ਜਿਹੜੀ ਖੇਡਾਂ ਹੈ ਉਹ ਪਿੰਡ ਲੈਵਲ ਤੋਂ ਫਿਰ ਜ਼ਿਲ੍ਹੇ ਲੈਵਲ 'ਤੇ ਫਿਰ ਸਟੇਟ ਲੈਵਲ 'ਤੇ ਫਿਰ ਨੈਸ਼ਨਲ ਲੈਵਲ 'ਤੇ ਗੇਮ ਪੁੱਜ ਜਾਂਦੀ ਹੈ ਅਗਰ ਸਰਕਾਰ ਸਰਕਾਰਾਂ ਚਾਹੁਣ ਤਾਂ ਬੱਚਿਆਂ ਦੀ ਗੇਮਾਂ ਪ੍ਰਤੀ ਰੁਝਾਨ ਵਧਾ ਸਕਦੀਆਂ ਹਨ ਮੈਂ ਚਾਹੁੰਦਾ ਹੈ ਕਿ ਹਰੇਕ ਸਟੇਟ ਹਰੇਕ ਕੰਟਰੀ ਨੂੰ ਖੇਡਾਂ 'ਤੇ ਇੱਕ ਬਜਟ ਬਣਾਉਣਾ ਚਾਹੀਦਾ ਹੈ ਇੱਕ ਕਮੇਟੀਆਂ ਬਣਾਉਣਾ ਚਾਹੀਦੀਆਂ ਪਿੰਡ ਲੈਵਲ 'ਤੇ ਤਾਂ ਕਿ ਬੱਚੇ ਗੇ ਖੇਡਾਂ ਖੇਡਣ ਕੋਈ ਵੀ ਗੇਮ ਖੇਡ ਸਕਦੇ ਹਨ ਬਹੁਤ ਹੀ ਭਾਰਤ ਵਿੱਚ ਹ ਬਹੁਤ ਪ੍ਰਕਾਰ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਪੰਜਾਬ ਦੇ ਵਿੱਚ ਕਬੱਡੀ ਨੂੰ ਬਹੁਤ ਪ੍ਰਮੋਟ ਕੀਤਾ ਜਾਂਦਾ ਹੈ ਇਹ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਹੈ ਮੈਂ ਚਾਹੁੰਦਾ ਹਾਂ ਕਿ ਜਿਹੜੀ ਹੋਕੀ

ਕ੍ਰਿਕਟ ਨੂੰ ਪ੍ਰਮੋਸ਼ਨ ਬਹੁਤ ਮਿਲ ਰਹੀ ਹੈ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਹ ਸਾਡੀ ਨੈਸ਼ਨਲ ਗੇਮ ਹੈ ਇਹ ਪਿੰਡ ਲੈਵਲ 'ਤੇ ਖੇਡੀ ਜਾਵੇ ਅਤੇ ਜੋ ਜੋ ਹਾਕੀ ਸਾਡੀ ਅੱਜ ਪਿਛੜ ਰਹੀ ਹੈ ਉਹਨੂੰ ਉੱਪਰ ਲਿਆਂਦਾ ਜਾਵੇ ਹੋਰ ਬਹੁਤ ਸਾਰੀਆਂ ਗੇਮਾਂ ਹੈ ਫੁੱਟਬਾਲ ਹੈ ਫੁੱਟਬਾਲ ਗੇਮ ਨੂੰ ਵੀ ਬਹੁਤ ਹੀ ਅੱਗੇ ਲਿਜਾਣ ਦੀ ਲੋੜ ਹੈ ਅੱਜ ਵਰਲਡ ਕੱਪ ਜਦੋਂ ਹੁੰਦਾ ਹੈ ਫੁੱਟਬਾਲ ਦਾ ਤਾਂ ਸਾਡੀ ਟੀਮ ਕਦੇ ਵੀ ਕੁਆਲੀਫਾਈਵ ਨਹੀਂ ਕੀਤੀ ਹੈ ਫੁੱਟਬਾਲ ਗੇਮ ਹੈਲਥ ਫਿਟਨੈਸ ਬਹੁਤ ਜ਼ਿਆਦਾ ਆਉਂਦੀ ਹੈ ਉਹਦੇ ਵਿੱਚ ਜੋ ਵੀ ਫੁੱਟਬਾਲਰ ਹੈ ਅੱਜ ਦੁਨੀਆਂ ਦੇ ਵਿੱਚ ਕਰੋੜਾਂ ਰੁਪਏ ਕਮਾ ਰਹੇ ਹਨ ਸਾਡੇ ਵੀ ਭਾਰਤ ਦੇ ਵਿੱਚ ਕੁਝ ਫੁੱਟਬਾਲਰ ਹੈ ਜੋ ਅੱਛਾ ਨਾਮ ਕਮਾ ਰਹੇ ਹਨ ਮੈਂ ਚਾਹੁੰਦਾ ਹੈ ਕਿ ਮੈਂ ਭਾਰਤ ਗੌਰਮੈਂਟ ਮੇਰੀ ਅਪੀਲ ਹੈ ਪਈ ਫੁੱਟਬਾਲ ਹਾਕੀ ਸਵੀਮਿੰਗ ਔਰ ਜਿਮਨਾਸਟਿੰਗ ਵਰਗੀਆਂ ਹੋਰ ਬਹੁਤ ਸਾਰੀਆਂ ਖੇਡਾਂ ਵੱਲ ਧਿਆਨ ਲਿਆਂਦਾ ਜਾਵੇ ਕਿ ਜਾਂ ਤਾਂ ਕਿ ਓਲੰਪਿਕਸ ਦੇ ਵਿੱਚ ਸਾਡੇ ਜਿਹੜੇ ਗੋਲਡ ਮੈਡਲ ਵਧਣ ਇਹ ਮੇਰੀ ਭਾਰਤ ਸਰਕਾਰ ਨੂੰ ਅਪੀਲ ਹੈ ਜੀ